ਅਸੀਂ ਉੱਤਰੀ ਭਾਰਤੀ ਜਾਂ ਦੱਖਣੀ ਭਾਰਤੀ ਜਾਂ ਮਹਾਂਦੀਪੀ ਭੋਜਨ ਖਾਣ ਲਈ ਪਸੰਦ ਕਰਾਂਗੇ ਸਿਰਫ ਉੱਤਰੀ ਭਾਰਤੀ ਦੀ ਕਿਉਂਕਿ ਹਰ ਇੱਕ ਜਗ੍ਹਾ ਦੀ ਆਪਣੀ ਆਪਣੀ ਖਾਣ ਦਾ ਟੇਸਟ ਹੁੰਦਾ ਵਾ ਸਵਾਦ ਹੁੰਦਾ ਹੈ ਜਿਸ ਕਰਕੇ ਅਸੀਂ ਤਾਂ ਉੱਤਰੀ ਭਾਰਤ ਦੀ ਭਾਰਤ ਦੀ ਏ ਪੰਜਾਬ ਵਿੱਚ ਰਹਿਣ ਵਾਲੇ ਹਾਂ ਅਸੀਂ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਸਾਡੇ ਬਹੁਤ ਮਸ਼ਹੂਰ ਆ ਜਿਸ ਕਰਕੇ ਅਸੀਂ ਖਾਣਾ ਵੀ ਪਸੰਦ ਜ਼ਿਆਦਾ ਇਹੋ ਕਰਦੇ ਹਾਂ ਲੋਕ ਜ਼ਿਆਦਾ ਪਸੰਦ ਇਹੋ ਕਰਦੇ ਨੇ ਕਿ ਮੱਕੀ ਦੀ ਰੋਟੀ ਸਰੋਂ ਦਾ ਸਾਗ ਹੋਵੇ ਨਾਲ ਸਾਡੇ ਮੱਖਣ ਜਾਂ ਦਹੀਂ ਲੱਸੀ ਪੀਂਦੇ ਹਾਂ ਅਤੇ ਬਾਕੀ ਦੱਖਣੀ ਭਾਰਤੀ ਮਹਾਂਦੀਪੀ ਭੋਜਨ ਜਿਹੜੇ ਆ ਉਹ ਉਹਨਾਂ ਦਾ ਟੇਸਟ ਉਹਨਾਂ ਨੂੰ ਪਸੰਦ ਹੁੰਦਾ ਜਿਹੜੇ ਉੱਥੇ ਰਹਿੰਦੇ ਆ ਕਿ ਮੈਂ ਤਾਂ ਇੱਥੇ ਪੰਜਾਬ 'ਚ ਰਹਿੰਦੀ ਹਾਂ ਜਿਸ ਕਰਕੇ ਮੈਨੂੰ ਉੱਤਰੀ ਭਾਰਤੀ ਖਾਣਾ ਹੀ ਪਸੰਦ ਹੈਗਾ ਹੈਗਾ ਹੈ ਅਤੇ ਮੈਂ ਬਣਾਉਣਾ ਵੀ ਉਹੀ ਪਸੰਦ ਕਰਾਂਗੀ ਜਿਹਦੇ ਵਿੱਚ ਮੈਨੂੰ ਇੰਟਰਸਟ ਹੈਗਾ ਮੈਨੂੰ ਜਿਹ 'ਚ ਸਵਾਦ ਆਉਂਦਾ ਵਾ ਅਤੇ ਮੈਨੂੰ ਬਣਾਉਣ ਦੀ ਵਿਧੀਆਂ ਵੀ ਮੈਨੂੰ ਇਹੀ ਪਤਾ ਇਸ ਕਰਕੇ ਮੈਂ ਇਹੋ ਪਸੰਦ ਕਰੂੰਗੀ ਉੱਤਰੀ ਭਾਰਤੀ ਖਾਣਾ ਬਣਾਉਣਾ